ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਕੋਮਲਪ੍ਰੀਤ ਕੌਰ ਹੈ ਮੈਂ ਪੰਜਾਬ ਦੀ ਰਹਿਣ ਵਾਲੀ ਹਾਂ ਅੱਜ ਮੈਂ ਤੁਹਾਡੇ ਸਾਰਿਆਂ ਨੂੰ ਇੱਕ ਬਹੁਤ ਹੀ ਗੰਭੀਰ ਮੁੱਦੇ ਉੱਤੇ ਗੱਲ ਕਰਨਾ ਚਾਹਵਾਂਗੀ ਜੋ ਕਿ ਹੈ ਟੋਪਿਕ ਦਾ ਨਾਮ ਹੈਗਾ ਹੈ ਬੱਚਿਆਂ ਦੇ ਉੱਤੇ ਟੈਕਨੋਲੋਜੀ ਦਾ ਕੀ ਬੁਰਾ ਅਸਰ ਔਰ ਪ੍ਰਭਾਵ ਪੈ ਰਿਹਾ ਹੈ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਹੈਗਾ ਆ ਕਿ ਅੱਜ ਕੱਲ੍ਹ ਜਿਹੜੇ ਬੱਚੇ ਹੈਗੇ ਆ ਉਹ ਮੋਬਾਇਲ ਫੋਨਸ ਇਲੈਕਟਰੋਨਿਕ ਐਪਲਾਇਨਸਸ ਤੋਂ ਨਾਲ ਬਹੁਤ ਹੀ ਜ਼ਿਆਦਾ ਕਨੈਕਟ ਕਰ ਚੁੱਕੇ ਨੇ ਅਤੇ ਇਸ ਕਰਕੇ ਉਹ ਬਾਹਰ ਫਿਜੀਕਲ ਐਕਟੀਵਿਟੀਜ ਵੀ ਨਹੀਂ ਕਰਦੇ ਫਿਜੀਕਲ ਖੇਡਾਂ ਵੀ ਨਹੀਂ ਖੇਡਦੇ ਸਿਰਫ਼ ਮੋਬਾਈਲ ਉੱਤੇ ਗੇਮ ਖੇਡਦੇ ਨੇ ਅਤੇ ਜ਼ਿਆਦਾ ਤੋਂ ਜ਼ਿਆਦਾ ਆਪਣਾ ਸਮੇਂ ਜੋ ਹੈ ਉਹ ਇਲੈਕਟਰੋਨਿਕ ਚੀਜ਼ਾਂ ਦੇ ਨਾਲ ਖ਼ਾਸ ਕਰਕੇ ਮੋਬਾਇਲ ਫੋਨਸ ਦੇ ਉੱਤੇ ਹੀ ਬਿਤਾਉਂਦੇ ਨੇ ਜੋ ਕਿ ਬਹੁਤ ਹਾਨੀਕਾਰਕ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜੋ ਏ ਇਹ ਇਲੈਕਟਰੋਨਿਕਸ ਚੀਜ਼ਾਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਵੇਬਸ ਬਹੁਤ ਸ਼ਾਰਪ ਹੁੰਦੀਆਂ ਨੇ ਇਹਨਾਂ ਦੀਆਂ ਜਿਹੜੀਆਂ ਵੇਬਸ ਹੁੰਦੀਆਂ ਨੇ ਉਹ ਸਾਡੇ ਬੋਡੀ ਦੇ ਅੰਦਰ ਪੈਨਫਿਟ ਵੀ ਕਰਦੀਆਂ ਨੇ ਅਤੇ ਇਹ ਸਾਨੂੰ ਬਹੁਤ ਹਾਮ ਪਹੁੰਚਾਉਂਦੀਆਂ ਨੇ ਅਤੇ ਇਹਦੇ ਨਾਲ ਹੀ ਬੱਚਿਆਂ ਦੀ ਨਿਗ੍ਹਾ 'ਤੇ ਬਹੁਤ ਬੁਰਾ ਅਸਰ ਪੈਂਦਾ ਹੈ ਅਤੇ ਅੱਜ ਕੱਲ੍ਹ ਆਪਾਂ ਨੂੰ ਪਤਾ ਹੈ ਕਿ ਇੰਟਰਨੈਟ ਜੋ ਕਿ ਮੋਬਾਈਲ ਦੇ ਉੱਤੇ ਚੱਲਦਾ ਹੈ ਮੋਬਾਇਲ 'ਤੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਕੁਛ ਗਲਤ ਚੀਜ਼ਾਂ ਕੁਛ ਚੰਗੀਆਂ ਚੀਜ਼ਾਂ ਵੀ ਚੱਲਦੀਆਂ ਨੇ ਅਤੇ ਬੱਚਿਆਂ ਬੱਚੇ ਇਹ ਸਭ ਵੇਖਦੇ ਨੇ ਕਿਉਂਕਿ ਜਾਣੇ ਅਣਜਾਣੇ ਤੇ ਨਾ ਹੁੰਦੇ ਹੋਏ ਇਹ ਸਭ ਦੇਖੇੇ ਦੇਖ ਹੋ ਜਾਂਦਾ ਬੱਚਿਆਂ ਤੋਂ ਬੱਚੇ ਫੋਨ ਚਲਾਉਂਦੇ ਨੇ ਕੁਛ ਇੱਦਾਂ ਦੇ ਚੀਜ਼ਾਂ ਅੱਗੇ ਆ ਜਾਂਦੀਆਂ ਨੇ ਜੋ ਕਿ ਉਹਨਾਂ ਦਾ ਮਾਨਸਿਕ ਸੰਤੁਲਨ ਵੀ ਖਰਾਬ ਕਰ ਸਕਦੀਆਂ ਨੇ ਅਤੇ ਮੈਂ ਸਭ ਨੂੰ ਇਹ ਗੁਜ਼ਾਰਿਸ਼ ਕਰਨਾ ਚਾਹਵਾਂਗੀ ਘਰਦਿਆਂ ਨੂੰ ਘੱਟ ਤੋਂ ਘੱਟ ਬੱਚੇ ਨੂੰ ਆਪਣਾ ਫੋਨ ਦਿਓ ਅਤੇ ਖ਼ਾਸ ਕਰਕੇ ਉਹਨਾਂ 'ਤੇ ਨਿਗ੍ਹਾ ਰੱਖੋ ਕਿ ਉਹ ਕੀ ਵੇਖਦੇ ਨੇ ਕੀ ਨਹੀਂ ਵੇਖਦੇ ਸਿਰਫ਼ ਕੰਮ ਦੇ ਤੌਰ 'ਤੇ ਹੀ ਉਹਨਾਂ ਨੂੰ ਫੋਨ ਦਿੱਤਾ ਜਾਵੇ ਤਾਂ ਕਿ ਉਹਨਾਂ ਦੀ ਸਿਹਤ ਵੀ ਚੰਗੀ ਰਹੇ ਅਤੇ ਆਪਾਂ ਟੈਕਨੋਲੋਜੀ ਦਾ ਉਹਨਾਂ 'ਤੇ ਗਲਤ ਅਸਰ ਵੀ ਨਾ ਹੋਣ ਦੇਈਏ ਧੰਨਵਾਦ